ਜਿਵੇਂ ਕਿ ਪੰਜਾਬ ਦੀ ਟਕਸਾਲੀ ਜਾਂ ਮੁੱਖ ਭਾਸ਼ਾ ਪੰਜਾਬੀ ਨੂੰ ਹੀ ਮੰਨਿਆ ਗਿਆ ਹੈ ਇਸ ਕਰਕੇ ਪੰਜਾਬ ਦੇ ਬੱਚੇ ਬੱਚੇ ਲਈ ਪੰਜਾਬੀ ਭਾਸ਼ਾ ਨੂੰ ਜ ਸਿੱਖਣਾ ਬੋਲਣਾ ਅਤੇ ਪੜ੍ਹਨਾ ਲਾਜ਼ਮੀ ਹੈ ਸਾਡੇ ਗੁਰੂਆਂ ਦੀ ਬਾਣੀ ਵੀ ਪੰਜਾਬੀ ਵਿੱਚ ਹੀ ਦਰਜ ਹੈ ਉਹ ਵੀ ਮਨੁੱਖੀ ਇਤਿਹਾਸ ਵਿੱਚ ਬਹੁਤ ਅਹਿਮੀਅਤ ਰੱਖਦੀ ਹੈ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਤਾਂ ਆਉਣੀ ਹੀ ਚਾਹੀਦੀ ਆ ਕਿਉਂਕਿ ਪੰਜਾਬ ਦੇ ਵਿੱਚ ਪੰਜਾਬੀ ਬੋਲਣ ਤੋਂ ਬਿਨਾਂ ਨਹੀਂ ਸ ਸਰ ਸਕਦਾ ਪਰੰਤੂ ਅੱਜ ਕੱਲ੍ਹ ਇੱਕ ਵੱਖਰਾ ਜਾ ਰੁਝਾਨ ਚੱਲ ਰਿਹਾ ਹੈ ਜਿਹਦੇ ਨਾਲ ਵੀ ਲੋਕ ਕਿਸੇ ਨਾਲ ਇੰਗਲਿਸ਼ 'ਚ ਗੱਲ ਕਰਦੇ ਹਨ ਜੋ ਕਿ ਇੰਗਲਿਸ਼ ਵਿੱਚ ਗੱਲ ਕਰਦੇ ਹਨ ਲੋਕ ਉਹਨਾਂ ਨੂੰ ਜ਼ਿਆਦਾ ਪੜ੍ਹਿਆ ਲਿਖਿਆ ਸਮਝਦੇ ਹਨ ਪਰੰਤੂ ਇਹੋ ਜਿਹੀ ਕੋਈ ਗੱਲ ਨਹੀਂ ਆ ਜਿਹੜਾ ਬੰਦਾ ਵੀ ਪੰਜਾਬੀ ਬੋਲਦਾ ਏ ਉਹ ਵੀ ਇੱਕ ਗਿਆਨਵਾਨ ਬੰਦਾ ਹੋ ਸਕਦਾ ਹੈ ਆਪਣੀ ਭਾਸ਼ਾ ਵਿੱਚ ਹੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਜੇਕਰ ਅਸੀਂ ਬਾਹਰ ਵੀ ਕਿਧਰੇ ਜਾਈਏ ਤਾਂ ਸਾਨੂੰ ਜੇਕਰ ਦੋ ਪੰਜਾਬੀ ਕਿਧਰੇ ਵੀ ਇੱਕਠੇ ਹੋਣ ਤਾਂ ਉਹਨਾਂ ਨੂੰ ਆਪਣੀ ਭਾਸ਼ਾ ਵਿੱਚ ਹੀ ਗੱਲ ਕਰਨੀ ਚਾਹੀਦੀ ਹੈ ਮੇਰੇ ਹਿਸਾਬ ਨਾਲ ਕਿਉਂਕਿ ਸਾਡਾ ਸੱਭਿਆਚਾਰ ਗੁਵਾਚਦਾ ਜਾ ਰਿਹਾ ਹੈ ਪੰਜਾਬੀ ਭੋ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਸਾਂਭਿਆ ਹੀ ਸਾਂਭੇ ਜਾ ਸਕਦੇ ਹਨ ਉਸ ਤਰ੍ਹਾਂ ਤਾਂ ਇਹ ਅਲੋਪ ਹੋ ਰਹੇ ਹਨ ਕਈ ਭਾਸ਼ਾਵਾਂ ਦੁਨੀਆਂ 'ਤੇ ਅਲੋਪ ਹੋ ਰਹੀਆਂ ਹਨ ਸਾਡੀ ਪੰਜਾਬੀ ਭਾਸ਼ਾ ਵੀ ਅਲੋਪ ਹੋਣ ਦੀ ਕਾਗਾਰ 'ਤੇ ਆ ਰਹੀ ਹੈ ਕਿਉਂਕਿ ਅਸੀਂ ਇਸ ਨੂੰ ਬੋਲਣ ਵਿੱਚ ਸ਼ਰਮ ਸ਼ਰਮਿੰਦਾ ਹੁੰਦੇ ਹਨ ਕਈ ਲੋਕ ਪੰਜਾਬੀ ਭਾਸ਼ਾ ਨੂੰ ਆਪਣੀ ਭਾਸ਼ਾ ਦੱਸਣ ਵਿੱਚ ਜਾਂ ਪੰਜਾਬੀ ਬੋਲਣ ਵਿੱਚ ਸ਼ਰ ਸ਼ਰਮਿੰਦਗੀ ਮਹਿਸੂਸ ਕਰਦੇ ਹਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਪੰਜਾਬੀ ਭਾਸ਼ਾ ਬੋਲਣੀ ਚਾਹੀਦੀ ਹੈ ਇਸ 'ਤੇ ਵਿਚਾਰ ਕਰਨੀ ਚਾਹੀਦਾ ਹੈ ਅਤੇ ਕਦੇ ਵੀ ਇਸ ਨੂੰ ਬੋਲਣ ਵਿੱਚ ਸ਼ਰਮਿੰਦਗੀ ਮਹਿਸੂਸ ਨਹੀਂ ਕਰਨੀ ਚਾਹੀਦੀ ਇਹ ਪੰਜਾਬੀ ਭਾਸ਼ਾ ਪੰਜਾਬ ਨਾਲ ਪੰਜਾਬ ਦੇ ਲੋਕਾਂ ਨੂੰ ਜੋੜ ਕੇ ਰੱਖਦੀ ਹੈ ਪਜਾਣੇ ਸ ਪੁਰਾਣੇ ਸੱਭਿਆਚਾਰ ਨੂੰ ਪੰਜਾਬ ਦੇ ਨਾਲ ਜੋੜ ਕੇ ਰੱਖਦੀ ਹੈ